ਛੇ ਜੂਨ ਉੱਨੀ ਸੌ ਚੁਰਾਸੀ ਪੰਦਰਾਂ ਅਗਸਤ ਉੱਨੀ ਸੌ ਸੰਤਾਲੀ ਦੋ ਜੂਨ ਉੱਨੀ ਸੌ ਚੁਰਾਨਵੇਂ ਛੱਬੀ ਜਨਵਰੀ ਉੱਨੀ ਸੌ ਪੰਜਾਹ ਪੰਦਰਾਂ ਮਈ ਉੱਨੀ ਸੌ ਤਰਾਨਵੇਂ